ਪੰਜਾਬ ਦੇ ਲੋਕ ਖਾਣ ਪੀਣ ਦੇ ਕਾਫੀ ਸ਼ੌਕੀਨ ਹਨ ਪੰਜਾਬ ਵਿੱਚ ਬਹੁਤ ਰੈਸਟੋਰੈਂਟ ਹਨ ਕਈ ਤਰ੍ਹਾਂ ਦੇ ਢਾਬੇ ਹਨ ਜਿਵੇਂ ਕਿ ਭਰਾਵਾਂ ਦਾ ਢਾਬਾ ਕਟਾਨੀ ਦਾ ਢਾਬਾ ਰਾਜੇ ਦਾ ਢਾਬਾ ਅਤੇ ਲਵਲੀ ਲੱਕੀ ਦਾ ਢਾਬਾ ਇਸ ਤਰ੍ਹਾਂ ਦੇ ਕਈ ਢਾਬੇ ਪੰਜਾਬ ਵਿੱਚ ਥਾਂ ਥਾਂ 'ਤੇ ਖੁੱਲ੍ਹੇ ਹਨ ਇਹਨਾਂ ਢਾਬਿਆਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜੋ ਪੰਜਾਬ ਦੀ ਪਹਿਚਾਣ ਬਾਰੇ ਲੋਕਾਂ ਨੂੰ ਦੱਸਦੇ ਹਨ ਜਿਵੇਂ ਹਰ ਢਾਬੇ ਵਿੱਚ ਮਿਲਣ ਵਾਲੇ ਪਕਵਾਨ ਜਿਵੇਂ ਕਿ ਦਾਲ ਮੱਖਣੀ ਸ਼ਾਹੀ ਪਨੀਰ ਅੰਮ੍ਰਿਤਸਰੀ ਕੁਲਚਾ ਤੰਦੂਰੀ ਨਾਨ ਇਸ ਤਰ੍ਹਾਂ ਦੇ ਕਈ ਨਾਨ ਵੀ ਮਿਲਦੇ ਹਨ ਮਿਕਸ ਸਬਜ਼ੀ ਮਲਾਈ ਵਾਲੀ ਲੱਸੀ ਦੁੱਧ ਜਲੇਬੀ ਬਹੁਤ ਤਰ੍ਹਾਂ ਦੇ ਪਕਵਾਨ ਹਨ ਜੋ ਕਿ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਣੇ ਹੋਏ ਹਨ